ਰੋਪੜ ਇੱਕ ਪੁਰਾਣਾ ਜ਼ਿਲ੍ਹਾ ਹੈਗਾ ਇਸ ਜ਼ਿਲ੍ਹੇ ਵਿੱਚ ਇੰਡਸਟਰੀ ਬਹੁਤ ਘੱਟ ਹੈਗੀ ਹੈ ਇਸ ਜ਼ਿਲ੍ਹੇ ਵਿੱਚ ਇੱਕ ਥਰਮਲ ਪਲਾਂਟ ਹੈ ਅਤੇ ਨਾਲ ਇੱਕ ਸੰਸਥਾ ਆਈ ਆਈ ਟੀ ਵੀ ਇੱਧਰ ਆ ਗਿਆ ਹੈ ਇਹ ਸਥਾਨ ਇਹ ਦੋਵਾਂ ਸੰਸਥਾਨ ਵਿੱਚ ਜਿਹੜੇ ਮੂਲ ਨਿਵਾਸੀ ਹੈ ਇਹਨਾਂ ਨੂੰ ਨੌਕਰੀ ਦਾ ਅਵਸਰ ਪ੍ਰਾਪਤ ਹੋਇਆ ਹੈ ਜਿਹਦੇ ਕਰਕੇ ਇਹਨਾਂ ਦੀ ਆਰਥਿਕ ਸਥਿਤੀ ਬਹੁਤ ਸੁਧਰੀ ਹੈ ਇਸ ਤੋਂ ਬਾਅਦ ਜਿੱਦਾਂ ਜਿੱਦਾਂ ਖੇਤਰ ਦਾ ਡਿਵਲੈਪਮੈਂਟ ਹੋਇਆ ਹੈ ਅਤੇ ਇਹਦੇ ਨਾਲ ਇੱਥੇ ਸੜਕ ਸੈਪਟਿਕ ਰਿੰਗ ਇਹ ਸਾਰੇ ਕੰਮ ਵੀ ਪੂਰਨ ਹੋ ਗਏ ਹੈਗੇ ਹੈ ਜਿਹਦੇ ਨਾਲ ਲੋਕਾਂ ਦੀ ਰਹਿਣ ਸਹਿਣ ਦਾ ਸਤਰ ਉੱਤੇ ਆਇਆ ਹੈ